ਤਰਨਤਾਰਨ ਜ਼ਿਲ੍ਹੇ ਵਿੱਚ ਮਨਾਏ ਜਾਣ ਵਾਲੇ ਮੁੱਖ ਸੱਭਿਆਚਾਰਕ ਤਿਉਹਾਰ ਮਕਰ ਸੰਕ੍ਰਾਂਤੀ ਦਾ ਤਿਉਹਾਰ ਹੈ ਮਕਰ ਸੰਕ੍ਰਾਂਤੀ ਦਾ ਤਿਉਹਾਰ ਹਰ ਸਾਲ ਪੰਦਰਾਂ ਜਨਵਰੀ ਨੂੰ ਮਨਾਇਆ ਜਾਂਦਾ ਹੈ ਇਸ ਦਿਨ ਸੂਰਜ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਮਕਰ ਸੰਕ੍ਰਾਂਤੀ ਤੋਂ ਹੀ ਮੌਸਮ ਬਦਲਣਾ ਸ਼ੁਰੂ ਹੋ ਜਾਂਦਾ ਹੈ ਭਾਰਤ ਦੇ ਵੱਖ ਵੱਖ ਖੇਤਰਾਂ ਵਿੱਚ ਇਹ ਇਤਿਹਾਸ ਸਥਾਨਕ ਮਾਨਤਾਵਾਂ ਅਨੁਸਾਰ ਧੂਮਧਾਮ ਨਾਲ਼ ਮਨਾਇਆ ਜਾਂਦਾ ਹੈ ਮਕਰ ਸੰਕ੍ਰਾਂਤੀ ਦੇ ਦਿਨ ਦਾਨ ਕਰਨ ਨਾਲ਼ ਵਿਅਕਤੀ ਨੂੰ ਕਈ ਤਰ੍ਹਾਂ ਦੇ ਲਾਭ ਪ੍ਰਾਪਤ ਹੁੰਦੇ ਹਨ ਮਕਰ ਸੰਕ੍ਰਾਂਤੀ ਨਾਲ਼ ਸ਼ਨੀ ਦੇਵ ਅਤੇ ਸੂਰਜ ਦੇਵ ਦੀ ਇੱਕ ਮਿਥਿਹਾਸਿਕ ਕਹਾਣੀ ਜੁੜੀ ਹੈ ਦੇਵੀ ਪੁਰਾਨ ਵਿੱਚ ਦੱਸਿਆ ਗਿਆ ਹੈ ਕਿ ਜਦੋਂ ਸੂਰਜ ਦੇਵ ਪਹਿਲੀ ਵਾਰ ਆਪਣੇ ਪੁੱਤਰ ਸ਼ਨੀਦੇਵ ਨੂੰ ਮਿਲਣ ਗਏ ਤਾਂ ਸ਼ਨੀਦੇਵ ਨੇ ਉਹਨਾਂ ਨੂੰ ਕਾਲਾ ਤਿਲ਼ ਭੇਂਟ ਕੀਤਾ ਅਤੇ ਉਸ ਨਾਲ਼ ਹੀ ਉਹਨਾਂ ਦੀ ਪੂਜਾ ਹੋਈ ਇਸ ਤੋਂ ਸੂਰਜ ਦੇਵਤਾ ਵੀ ਪ੍ਰਸੰਨ ਹੋਏ ਸੂਰਜ ਨੇ ਸ਼ਨੀ ਨੂੰ ਆਸ਼ੀਰਵਾਦ ਦਿੱਤਾ ਕਿ ਜਦੋਂ ਉਹ ਮਕਰ ਸੰਕ੍ਰਾਂਤੀ ਵਿੱਚ ਉਸਦੇ ਘਰ ਜਾਵੇਗਾ ਤਾਂ ਉਸਦਾ ਘਰ ਧਨ ਦੌਲਤ ਨਾਲ਼ ਭਰ ਜਾਵੇਗਾ ਉਸ ਤੋਂ ਮਕਰ ਸੰਕ੍ਰਾਂਤੀ ਮਨਾਈ ਜਾਂਦੀ ਹੈ ਮਕਰ ਸੰਕ੍ਰਾਂਤੀ ਦੇ ਦਿਨ ਇਸ਼ਨਾਨ ਕਰਨ ਤੋਂ ਪਹਿਲਾਂ ਕੁਝ ਵੀ ਖਾਣਾ ਨਹੀਂ ਚਾਹੀਦਾ ਅਤੇ ਨਾ ਹੀ ਪੀਣਾ ਚਾਹੀਦਾ ਹੈ ਮਕਰ ਸੰਕ੍ਰਾਂਤੀ ਦੇ ਦਿਨ ਤਿਲ਼ ਦਾ ਦਾਨ ਕਰਨਾ ਬਹੁਤ ਲਾਭਦਾਇਕ ਹੈ ਇਸ ਦਿਨ ਕਾਲੇ ਤਿਲ਼ ਦਾ ਦਾਨ ਕਰਨ ਨਾਲ਼ ਸ਼ਨੀ ਦੀ ਸਾੜ ਸਤੀ ਅਤੇ ਧਈਆ ਤੋਂ ਰਾਹਤ ਮਿਲਦੀ ਹੈ ਮਕਰ ਸੰਕ੍ਰਾਂਤੀ ਦੇ ਦਿਨ ਸੂਰਜ ਦੇਵਤਾ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਹੈ ਇਹ ਦਿਨ ਉਹਨਾਂ ਨੂੰ ਖੁਸ਼ ਕਰਨ ਲਈ ਸੂਰਜ ਦੇਵਤਾ ਦੇ ਮੰਤਰਾਂ ਦਾ ਜਾਪ ਕਰਨਾ ਚਾਹੀਦਾ ਹੈ ਇਸ ਦਿਨ ਤਿਲ਼ ਅਤੇ ਮੂੰਗੀ ਦੀ ਦਾਲ ਦੀ ਬਣੀ ਖਿਚੜੀ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਮਕਰ ਸੰਕ੍ਰਾਂਤੀ ਦਾ ਤਿਉਹਾਰ ਭਾਰਤ ਅਤੇ ਕਈ ਹੋਰ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ